ਹਾਂਜੀ ਸਰ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹਾਂਜੀ ਸਰ ਹਾਂਜੀ ਸਰ ਆਪਣੇ ਕੋਲ ਹਰੇਕ ਤਰ੍ਹਾਂ ਦਾ ਬੂਟਾ ਮਿਲ ਸਕਦਾ ਤੁਸੀਂ ਜਿਹੜਾ ਜਿਹੜਾ ਬੂਟਾ ਲੈਣਾ ਹੈਗਾ ਉਸਦੀ ਲਿਸਟ ਬਣਾ ਕੇ ਸਾਨੂੰ ਐਸ ਐਮ ਐਸ ਕਰ ਦਿਓ ਉਹ ਤੋਂ ਬਾਅਦ ਅਸੀਂ ਵੀ ਉਹਨਾਂ ਦੇ ਰੇਟ ਲਿਸਟ ਬਣਾ ਕੇ ਫਿਰ ਤੁਹਾਨੂੰ ਦੱਸ ਦੇਵਾਂਗੇ ਵੀ ਇੰਨੇ ਇੰਨੇ ਦਾ ਇਹ ਬੂਟਾ ਆਪਾਂ ਨੂੰ ਪੈ ਸਕਦਾ ਹੈ ਇੱਕ ਬੂਟਾ ਇੰਨੇ ਦਾ ਪੈਂਦਾ ਹੈਗਾ ਦਸ ਬੂਟੇ ਇੰਨੇ ਦੇ ਪੈਂਦੇ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਜੀ ਹਾਂਜੀ ਸਰ ਅਸੀਂ ਉਹ ਵੀ ਭੇਜ ਸਕਦੇ ਹਾਂ ਤੁਸੀਂ ਪਹਿਲਾਂ ਸਾਨੂੰ ਇੰਨਾਂ ਦੱਸ ਦਿਓ ਵੀ ਕਿੰਨੇ ਕਿਹੜੇ ਕਿਹੜੇ ਬੂਟੇ ਚਾਹੀਦੇ ਨੇ ਵੀਹ ਚਾਹੀਦੇ ਨੇ ਪੰਜਾਹ ਚਾਹੀਦੇ ਨੇ ਅਤੇ ਉਸ ਹਿਸਾਬ ਨਾਲ ਅਸੀਂ ਫਿਰ ਤੁਹਾਨੂੰ ਡਿਲੀਵਰੀ ਕਰ ਦਾਂਗੇ ਘਰ ਡਿਲੀਵਰੀ ਦੇ ਚਾਰਜ ਅਲੱਗ ਹੋਣਗੇ ਹਾਂਜੀ ਸਰ ਹਾਂਜੀ ਜਦੋਂ ਤੁਸੀਂ ਲੈਣ ਆਏ ਬੂਟੇ ਉਦੋਂ ਤੁਹਾਨੂੰ ਅਸੀਂ ਦੱਸ ਦੇਵਾਂਗੇ ਵੀ ਕੀ ਚੀਜ਼ ਕਿਸਨੂੰ ਚਾਹੀਦੀ

ਠੀਕ ਹੈ ਸਰ ਵੈਲਕਮ